ਪੰਜਾਬੀ ਭਾਸ਼ਾ ਦੀ ਤੁਲਨਾ ਆਪਾਂ ਕਿਸੇ ਭਾਸ਼ਾ ਨਾਲ ਤਾਂ ਨਹੀਂ ਕਰ ਸਕਦੇ ਬਟ ਆਪਾਂ ਹਿੰਦੀ ਦੇ ਨਾਲ ਪੰਜਾਬੀ ਭਾਸ਼ਾ ਦੀ ਤੁਲਨਾ ਕਰ ਸਕਦੇ ਹਾਂ ਕਿਉਂਕਿ ਪੰਜਾਬੀ ਦੇ ਹਿੰਦੀ ਦੇ ਕੁਛ ਸ਼ਬਦ ਏ ਇੱਕੋ ਜਿਹੇ ਹੁੰਦੇ ਹਨ ਜਿਨਾਂ ਦਾ ਮ ਅਰਥ ਵੀ ਇੱਕੋ ਜਿਹਾ ਹੁੰਦਾ ਹੈ ਅਤੇ ਉਹਨਾਂ ਨੂੰ ਆਪਾਂ ਨੂੰ ਸਮਝਣਾ ਲਿਖਣਾ ਅਤੇ ਬੋਲਣਾ ਦੋਨਾਂ ਚੀਜ਼ਾਂ ਵਿੱਚ ਆਪਾਂ ਉਹਨਾਂ ਨੂੰ ਇੱਕੋ ਜਿਹਾ ਉਹਦਾ ਅਰਥ ਨਿਕਲਦਾ ਹੈ ਜਿਵੇਂ ਕਿ ਆਪਾਂ ਪੰਜਾਬੀ ਭਾਸ਼ਾ ਵਿੱਚ ਬੋਲਦੇ ਹਾਂ ਪਿਤਾ ਜੀ ਤਾਂ ਹਿੰਦੀ ਵਿੱਚ ਵੀ ਆਪਾਂ ਪਿਤਾ ਜੀ ਹੀ ਬੋਲਦੇ ਹਾਂ ਜਿਵੇਂ ਕਿ ਪੰਜਾਬੀ ਭਾਸ਼ਾ ਵਿੱਚ ਬੋਲਦੇ ਹਾਂ ਆਪਾਂ ਨਦੀ ਜਾਂ ਨਹਿਰ 'ਤੇ ਆਪਾਂ ਹਿੰਦੀ ਭਾਸ਼ਾ ਦੇ ਵਿੱਚ ਵੀ ਨਦੀ ਜਾਂ ਨਹਿਰ ਹੀ ਬੋਲਦੇ ਹਾਂ ਜਿਵੇਂ ਕਿ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਕਿ ਅਸੀਂ ਜਾ ਰਹੇ ਹਾਂ ਅਤੇ ਆਪਾਂ ਉਹਨੂੰ ਹਿੰਦੀ ਭਾਸ਼ਾ ਦੇ ਵਿੱਚ ਵੀ ਐਵੇਂ ਬੋਲ ਸਕਦੇ ਆ ਕਿ ਅਸੀਂ ਜਾ ਰਹੇ ਹਾਂ ਅਤੇ ਕੋਈ ਇਹਨਾਂ ਨ ਦੋਨਾਂ ਭਾਸ਼ਾਵਾਂ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ ਹੈਗਾ ਇੱਕ ਦੀ ਜਗ੍ਹਾ 'ਤੇ ਦੂਜੇ ਸ਼ਬਦ ਦੀ ਵਰਤੋਂ ਕੀਤੀ ਜਾ ਸਕਦੀ ਹੈਗੀ ਆ ਇਹਨੂੰ ਸਮਝਿਆ ਵੀ ਜਾ ਸਕਦਾ ਹੈ ਬੋਲਿਆ ਵੀ ਜਾ ਸਕਦਾ ਹੈ ਅਤੇ ਦੋਨਾਂ ਦੀ ਤੁਲਨਾ ਕੀਤੀ ਜਾ ਸਕਦੀ ਜਿਵੇਂ ਕਿ ਅਸੀਂ ਕਹਿ ਦਿੰਦੇ ਆ ਵੀ ਅਸੀਂ ਸਕੂਲ ਸ਼ਬਦ ਹੋ ਗਿਆ ਜਾਂ ਮਾਤਾ ਸ਼ਬਦ ਹੋ ਗਿਆ ਉਹਦਾ ਪੰਜਾਬੀ ਅਤੇ ਹਿੰਦੀ ਦੋਨਾਂ ਦੇ ਵਿੱਚ ਅਰਥ ਬਿਲਕੁਲ ਸੇਮ ਹੀ ਹੁੰਦਾ ਹੈ ਅਤੇ ਦੋਨਾਂ ਦਾ ਉਹਨਾਂ ਦਾ ਗ ਆਪਾਂ ਜਿਹੜਾ ਹੈਗਾ ਗਾ ਤੁਲਨਾ ਨਹੀਂ ਕਰ ਸਕਦੇ ਮਤਲਬ ਕਿ ਉਹਦਾ ਅਰਥ ਵੀ ਸੇਮ ਹੋਵੇਗਾ ਅਤੇ ਉਸਦਾ ਅਰਥ ਵੀ ਸੇਮ ਹੀ ਹੋਵੇਗਾ ਜਿਵੇਂ ਕਿ ਆਪਾਂ ਹਿੰਦੀ ਭਾਸ਼ਾ ਵਿੱਚ ਬੋਲਦੇ ਹਾਂ ਦਹੀਂ ਅਤੇ ਆਪਾਂ ਪੰਜਾਬੀ ਭਾਸ਼ਾ ਵਿੱਚ ਵੀ ਹੁਣ ਦਹੀਂ ਹੀ ਬੋਲਦੇ ਹੈ ਜਿਵੇਂ ਕਿਤੇ ਕੋਈ ਜਿਵੇਂ ਆਪਾਂ ਸਕੂਲ ਬਾਰੇ ਗੱਲ ਕਰਦੇ ਹਾਂ ਕਾਲਜ ਵਾਲੇ ਗੱਲ ਕਰਦੇ ਹਾਂ ਤਾਂ ਉਹਨੂੰ ਵੀ ਆਪਾਂ ਪੰਜਾਬੀ ਦੇ ਹਿੰਦੀ ਦੋਨਾਂ ਦੇ ਵਿੱਚ ਇਹ ਇੱਕੋ ਜਿਹਾ ਹੀ ਬੋਲ ਸਕਦੇ ਹਾਂ ਬੋਲਣ ਦੇ ਨਾਲ ਸਾਨੂੰ ਮਤਲਬ ਜਿਹੜਾ ਬੋਲਦੇ ਆ ਉਹ ਸਮਝ ਵੀ ਲੱਗਦੀ ਹੈਗੀ ਆ ਅਤੇ ਸਬ ਸ਼ਬਦ ਜ਼ਿਆਦਾ ਸਮਝਣ ਵਿੱਚ ਸਾਨੂੰ ਮੁਸ਼ਕਿਲ ਨਹੀਂ ਆਉਂਦੀ ਪੰਜਾਬੀ ਅਤੇ ਆਪਾਂ ਹਿੰਦੀ ਦੋਨਾਂ ਭਾਸ਼ਾਵਾਂ ਦੀ ਮਾਤਰਾ ਮਤਲਬ ਇੱਕੋ ਜਿਹੇ ਅਰਥ ਅਤੇ ਇੱਕੋ ਜਿਹਾ ਬੋਲ ਸਕਦੇ ਹਾਂ